ਭਾਰ ਘਟਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਖਾਣੇ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਵੈਸੇ ਤਾਂ ਅਗਰ ਗੱਲ ਕਰੀ ਜਾਵੇ ਤਾਂ ਪਿੰਡਾਂ ਵਿੱਚ ਲਗਭਗ ਕੰਮ ਜ਼ਿਆਦਾ ਕਰਨ ਕਰਕੇ ਪਿੰਡਾਂ ਦੇ ਵਸਨੀਕ ਫਿੱਟ ਸਰੀਰ ਸਰੀਰਕ ਪੱਖੋਂ ਬਹੁਤ ਫਿੱਟ ਹੀ ਹੁੰਦੇ ਹਨ ਅਤੇ ਪਿੰਡਾਂ 'ਚ ਕੰਮ ਜ਼ਿਆਦਾ ਹੋਣ ਕਰਕੇ ਘੁੰਮਣ ਫਿਰਨ ਕਰਕੇ ਖੇਤੀਬਾੜੀ ਕਰਕੇ ਡੰਗਰ ਮੱਝਾਂ ਦਾ ਕੰਮ ਜ਼ਿਆਦਾ ਹੁੰਦਾ ਹੈ ਇਸ ਕਰਕੇ ਸਰੀਰ ਪੱਖੋਂ ਜ਼ਿਆਦਾ ਖ਼ਰਾਬ ਖ਼ਰਾਬ ਸਿਹਤ ਨਹੀਂ ਹੁੰਦੀ ਲੇਕਿਨ ਸਾਨੂੰ ਆਪਣੇ ਖਾਣ ਪੀਣ ਦਾ ਧਿਆਨ ਬਹੁਤ ਰੱਖਣਾ ਚਾਹੀਦਾ ਹੈ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ ਸਵੇਰ ਸ਼ਾਮ ਦੀ ਕਸਰਤ ਕਰਨੀ ਬਹੁਤ ਜ਼ਰੂਰੀ ਹੈ ਇਸ ਕਰਕੇ ਭਾਰ ਘੱਟ ਸਕਦਾ ਹੈ ਜਦੋਂ ਅਸੀਂ ਜ਼ਿਆਦਾ ਖਾ ਲੈਂਦੇ ਹਾਂ ਤਾਂ ਸਾਡਾ ਸਰੀਰ ਜ਼ਿਆਦਾ ਮੋਟਾ ਹੋ ਜਾਂਦਾ ਹੈ ਜਿਹੜਾ ਕਿ ਸਰੀਰਕ ਪੱਖੋਂ ਚੰਗਾ ਦੇਖਣ ਨੂੰ ਚੰਗਾ ਵੀ ਨਹੀਂ ਲੱਗਦਾ ਇਸ ਕਰਕੇ ਸਾਨੂੰ ਸਵੇਰ ਸ਼ਾਮ ਦੀ ਕਸਰਤ ਬਹੁਤ ਜ਼ਿਆਦਾ ਜ਼ਰੂਰੀ ਹੈ ਪਾਣੀ ਵੱਧ ਪੀਣਾ ਚਾਹੀਦਾ ਹੈ ਅਤੇ ਆਪਣੇ ਖਾਣ ਪੀਣ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਪਿੰਡਾਂ ਪਿੰਡਾਂ ਦੀ ਅਗਰ ਗੱਲ ਕਰੀ ਜਾਵੇ ਤਾਂ ਸਰੀਰਕ ਪੱਖੋਂ ਕੰਮ ਹੁਣ ਪਿੰਡਾਂ ਵਿੱਚ ਵੀ ਜ ਇੰਨੇ ਜਿਆਦਾ ਨਹੀਂ ਰਹੇ ਪਹਿਲਾਂ ਜ਼ਿਆਦਾ ਕੰਮ ਲੋਕ ਕਰਦੇ ਹੁੰਦੇ ਸੀ ਸਰੀਰਕ ਪੱਖੋਂ ਫਿੱਟ ਹੁੰਦੇ ਸੀ ਇਸ ਕਰਕੇ ਚਾਹੇ ਪਿੰਡ ਹੋਵੇ ਚਾਹੇ ਸ਼ਹਿਰ ਹੋਵੇ ਸਵੇਰ ਸ਼ਾਮ ਦੀ ਕਸਰਤ ਬਹੁਤ ਜ਼ਿਆਦਾ ਜ਼ਰੂਰੀ ਹੈ ਖਾਸ ਕਰਕੇ ਰਾਤ ਦੇ ਖਾਣੇ ਤੋਂ ਬਾਅਦ ਕਸਰਤ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹਦੀ ਰਾਤ ਨੂੰ ਆਪਣੇ ਢਿੱਡ ਦਾ ਡਸਟਬਿਨ ਬਣਾ ਦਿੰਦੇ ਹਾਂ ਜੋ ਵੀ ਖਾਂਦੇ ਹਾਂ ਖਾ ਕੇ ਸੌ ਜਾਂਦੇ ਹਾਂ ਸੌਣਾ ਗਲਤ ਸ਼ਾਮ ਦੀ ਸੈਰ ਕਰਨੀ ਬਹੁਤ ਜ਼ਰੂਰੀ ਹੈ ਜਿਸ ਨਾਲ ਸਰੀਰ ਮੋਟਾ ਨਹੀਂ ਹੁੰਦਾ ਔਰ ਸਾਡਾ ਸਰੀਰ ਫਿੱਟ ਰਹਿੰਦਾ ਹੈ ਸਤਿ ਸ਼੍ਰੀ ਅਕਾਲ ਜੀ